ਸਤਿ ਸ਼੍ਰੀ ਅਕਾਲ ਜੀ ਬਿਲਕੁਲ ਮੈਂ ਭਵਿੱਖ ਵਿੱਚ ਗਾਉਣਾ ਚਾਹਵਾਂਗੀ ਮੈਂ ਹੁਣ ਵੀ ਥੋੜ੍ਹਾ ਬਹੁਤ ਗਾਉਂਦੀ ਹਾਂ ਜਿੱਦਾਂ ਹੁਣ ਮੈਂ ਸਕੂਲ 'ਚ ਗਾਇਆ ਕਾਫ਼ੀ ਟਾਈਮ ਪਹਿਲਾਂ ਸਕੂਲ 'ਚ ਗਾਇਆ ਹੁਣ ਕੋਲਜ 'ਚ ਵੀ ਮੈਂ ਗਾ ਹੀ ਰਹੀ ਹਾਂ ਅਤੇ ਮੈਨੂੰ ਅਲੱਗ ਜਿਹਾ ਹੀ ਕੁਛ ਅਨੁਭਵ ਹੁੰਦਾ ਆ ਵਧੀਆ ਅਨੁਭਵ ਹੁੰਦਾ ਆ ਮੈਂ ਖੁਦ ਨੂੰ ਬਹੁਤ ਫਰੀ ਕਰਦੀ ਆਂ ਜਦੋਂ ਮੈਂ ਗਾਉਂਦੀ ਹਾਂ ਨਾ ਮੈਨੂੰ ਬਹੁਤ ਵਧੀਆ ਲੱਗਦਾ ਆ ਅਤੇ ਮੈਂ ਭਜਨ ਗਾਉਣੇ ਪਸੰਦ ਕਰਦੀ ਹਾਂ ਗਾਣੇ ਵੀ ਗਾਉਂਦੀ ਹਾਂ ਭਜਨ ਵੀ ਗਾਉਂਦੀ ਹਾਂ ਕਵਾਲੀਆਂ ਵੀ ਗਾਉਂਦੀ ਹਾਂ ਮੈਂ ਮੈਨੂੰ ਲੱਗਦਾ ਨਾ ਕਿ ਜਦੋਂ ਮਤਲਬ ਰੱਬ ਨਾਲ ਜੁੜਨ ਦਾ ਸਭ ਤੋਂ ਅੱਛਾ ਸਾਧਨ ਹੈ ਨਾ ਜੇ ਕੋਈ ਤਾਂ ਉਹ ਸੰਗੀਤ ਹੈ ਭਾਈ ਮਰਦਾਨਾ ਜੀ ਅਤੇ ਗੁਰੂ ਨਾਨਕ ਦੇਵ ਜੀ ਦੋਨੇ ਰਲ ਕੇ ਕੀਰਤਨ ਕਰਦੇ ਸੀਗੇ ਅਤੇ ਗਾ ਇਕੱਠੇ ਗਾਉਂਦੇ ਸੀਗੇ ਅਤੇ ਮੈਨੂੰ ਲੱਗਦਾ ਨਾ ਕਿ ਪ੍ਰਭੂ ਨਾਲ ਜੁੜਣ ਦਾ ਜੇ ਕੋਈ ਸਾਧਨ ਹੈਗਾ ਨਾ ਅਤੇ ਉਹ ਸੰਗੀਤ ਹੀ ਆ ਸੰਗੀਤ ਤੋਂ ਸਿਵਾ ਹੋਰ ਕੁਛ ਨਹੀਂ ਹੈਗਾ ਹੁਣ ਮੈਂ ਚਾਹੁੰਦੀ ਹਾਂ ਕਿ ਮੈਨੂੰ ਅੱਗੇ ਵਧਾ ਮੈਂ ਅੱਗੇ ਹੋਰ ਵਧਾ ਗਾਣਾ ਗਾਵਾਂ ਭਜਨ ਗਾਵਾਂ ਜਿਹਦੇ ਨਾਲ ਮੈਨੂੰ ਅੱਗੇ ਅੱਗੇ ਮੌਕੇ ਮਿਲਦੇ ਜਾਣ ਅਤੇ ਲਾਈਫ 'ਚ ਅੱਗੇ ਜਾ ਕੇ ਮੈਂ ਵਧੀਆ ਸਿੰਗਰ ਬਣਾ ਮੈਂ ਪਲੇਅ ਗਰੁ ਪਲੇਅਬੈਕ ਸਿੰਗਰ ਬਣਾ ਅਤੇ ਮੈਨੂੰ ਅੱਛਾ ਲੱਗੇ ਮੈਨੂੰ ਵਧੀਆ ਫੀਲ ਆਵੇ ਸੋ ਮੈਂ ਰੱਬ ਅੱਗੇ ਇੱਕ ਅਰਦਾਸ ਕਰਾਂਗੀ ਕਿ ਮੈਨੂੰ ਮੌਕੇ ਮਿਲਦੇ ਜਾਣ ਮੈਂ ਕਰਾਂ ਅੱਗੇ ਵੀ ਪਰਫੋਰਮ ਕਰਾਂ ਅੱਗੇ ਜਾਵਾਂ ਅੱਗੇ ਵਧਾ ਅਤੇ ਭਵਿੱਖ ਵਿੱਚ ਇੱਕ ਅੱਛੀ ਸਿੰਗਰ ਬਣਾ ਮੈਂ ਰੱਬ ਅੱਗੇ ਦੁਆ ਬੇਨਤੀ ਕਰਾਂਗੀ